ਸਾਡੇ ਕਾਲਜ ਵਿੱਚ ਇੱਕ ਫੰਕਸ਼ਨ ਸੀ ਜਿਸ ਵਿੱਚ ਸਾਨੂੰ ਸਾਰਿਆ ਨੂੰ ਡਾਂਸ ਕਰਨਾ ਪੈਣਾ ਸੀ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਨਰਵਸ ਸੀ ਫਿਰ ਹੌਲੀ ਹੌਲੀ ਮੇਰੀਆਂ ਸਹੇਲੀਆਂ ਨੇ ਮੈਨੂੰ ਹੌਸਲਾ ਦਿੱਤਾ ਅਤੇ ਮੈਂ ਡਾਂਸ ਕੀਤਾ ਕਰਨ ਲਈ ਹਾਂ ਕਹਿ ਦਿੱਤੀ ਕੁਛ ਦਿਨਾਂ ਤੱਕ ਸਾਡੀ ਡਾਂਸ ਪ੍ਰੈਟਿਸ ਚਲਦੀ ਰਹੀ ਲਗਾਤਾਰ ਕਾਲਜ ਵਿੱਚ ਫਿਰ ਇੱਕ ਜਿਸ ਦਿਨ ਫੰਕਸ਼ਨ ਸੀ ਉਸ ਤੋਂ ਇੱਕ ਦਿਨ ਪਹਿਲਾਂ ਜਿੱਥੇ ਫੰਕਸ਼ਨ ਹੋਣਾ ਸੀ ਉੱਥੇ ਅਸੀਂ ਉੱਥੇ ਅਸੀਂ ਫੰਕਸ਼ਨ ਦੀ ਸਾਰੀ ਤਿਆਰੀ ਕੀਤੀ ਸਾਰੀ ਡੈਕੋਰੇਸ਼ਨ ਕੀਤੀ ਅਤੇ ਫਿਰ ਸਾਡਾ ਜਿਸ ਦਿਨ ਸਾਡਾ ਫੰਕਸ਼ਨ ਸੀ ਅਸੀਂ ਨੇ ਬਹੁਤ ਸੋਹਣਾ ਡਾਂਸ ਕੀਤਾ ਸਾਡਾ ਗਰੁੱਪ ਡਾਂਸ ਵੀ ਹੋਇਆ ਅਤੇ ਅਸੀਂ ਇਕੱਲੇ ਕੱਲਿਆਂ ਨੇ ਵੀ ਡਾਂਸ ਅਤੇ ਜਦੋਂ ਅਸੀਂ ਇਕੱਲੇ ਕੱਲਿਆਂ ਨੇ ਵੀ ਪਰਫੋਮਸ ਦਿੱਤੀ ਅਤੇ ਸਾਡੇ ਟੀਚਰ ਸਾਥੋਂ ਬਹੁਤ ਖੁਸ਼ ਹੋਏ ਸਾਡੇ ਪ੍ਰਿੰਸੀਪਲ ਮੈਮ ਨੇ ਸਾਨੂੰ ਸ਼ਾਬਾਸ਼ੀ ਦਿੱਤੀ ਸਾਡੇ ਨਾਲ ਫੋਟੋਸ ਕਰਾਈ ਆ ਤਾਂ ਅਤੇ ਮੇਰੇ ਲਈ ਇਹ ਦਿਨ ਸਭ ਤੋਂ ਜ਼ਿਆਦਾ ਯਾਦਗਾਰ ਬਣ ਗਿਆ